ਜੇਕਰ ਮੈਂ ਸੱਭਿਆਚਾਰ ਦੀ ਗੱਲ ਕਰਾਂ ਤਾਂ ਇੱਦਾਂ ਦੇ ਬਹੁਤ ਸਾਰੇ ਫਰਿਸ਼ਤੇ ਹੋਏ ਹਨ ਜਿਨ੍ਹਾਂ ਨੇ ਸੱਭਿਆਚਾਰ ਨੂੰ ਆਕਾਰ ਦਿੱਤਾ ਹੈ ਉਹਨਾਂ ਵਿੱਚੋਂ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਸਨ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਸਨ ਉਹਨਾਂ ਨੇ ਬਹੁਤ ਸਾਰੀਆਂ ਪ੍ਰੇਰਨਾਵਾਂ ਦਿੱਤੀਆਂ ਹਨ ਜਿਵੇਂ ਕਿ ਜਾਤ ਪਾਤ ਤੋਂ ਜਿਵੇਂ ਕਿ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕੀਤਾ ਹੈ ਸਤੀ ਪ੍ਰਥਾ ਦਾ ਉਹਨਾਂ ਨੇ ਅੰਤ ਕੀਤਾ ਸੀ ਅਤੇ ਅਤੇ ਵਹਿਮਾ ਭਰਮਾਂ ਤੋਂ ਦੂਰ ਰਹਿਣ ਲਈ ਦੂਰ ਰਹਿਣ ਲਈ ਵੀ ਬੋਲਿਆ ਸੀ ਉਹਨਾਂ ਨੇ ਚਾਰ ਉਦਾਸੀਆਂ ਦਿੱਤੀਆਂ ਸਨ ਅਤੇ ਸਾਰਿਆਂ ਨੂੰ ਇੱਕ ਪੰਗਤ ਵਿੱਚ ਬੈਠ ਕੇ ਖਾਣ ਲਈ ਵੀ ਪ੍ਰੇਰਿਤ ਕੀਤਾ ਸੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਉਹਨਾਂ ਨੇ ਇੱਦਾਂ ਦੇ ਬਹੁਤ ਸਾਰੇ ਸਾਰੇ ਸ੍ਰੋਤ ਸਾਨੂੰ ਦਿੱਤੇ ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ ਅਤੇ ਉਹਨਾਂ ਤੋਂ ਬਾਅਦ ਵੀ ਜਿੰਨੇ ਗੁਰੂ ਹੋਏ ਹਨ ਉਹਨਾਂ ਨੇ ਵੀ ਕੁਛ ਨਾ ਕੁਛ ਸਾਡੇ ਸੱਭਿਆਚਾਰ ਨੂੰ ਆਕਾਰ ਦੇਣ ਲਈ ਅਤੇ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਸਿੱਖਿਆਵਾਂ ਦਿੱਤੀਆਂ ਹਨ